ਅੱਜ ਕੱਲ ਮੀਹਾਂ ਦੇ ਮੌਸਮਾਂ ਵਿੱਚ ਡੇਂਗੂ ਅਤੇ ਮਲੇਰੀਏ ਦੀ ਬਿਮਾਰੀ ਬਹੁਤ ਵੱਧ ਜਾਂਦੀ ਹੈ ਇਸ ਦੇ ਬਚਨ ਇਸ ਤੋਂ ਬਚਣ ਲਈ ਸਾਨੂੰ ਬਹੁਤ ਤਰ੍ਹਾਂ ਦੇ ਅਭਿਆਸਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਵੇਂ ਕਿ ਸਾਨੂੰ ਸਾਫ ਪਾਣੀ ਬਾਲਟੀਆਂ ਵਿੱਚ ਨਹੀਂ ਰੱਖਣਾ ਚਾਹੀਦਾ ਡਸਟਵੀਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਆਲੇ ਦੁਆਲੇ ਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਵੀ ਸਾਨੂੰ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਬਿਮਾਰੀਆਂ ਤੋਂ ਬਚਣ ਦੇ ਧਿਆਨ ਨਾਲ ਸਾਨੂੰ ਹਮੇਸ਼ਾ ਹੀ ਸਾਰੇ ਸਾਫ ਸੁਥਰੇ ਕੱਪੜਿਆਂ ਨੂੰ ਪਹਿਨਣਾ ਚਾਹੀਦਾ ਹੈ ਅਤੇ ਸਾਰੇ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਨਾਲੀਆਂ ਦੇ ਵਿੱਚ ਡੀਡੀਟੀ ਦਾ ਛੜਕਾ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਘਰਾਂ ਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਦਵਾਈ ਜੋ ਕਿ ਨੁਕਸਾਨ ਨਾ ਪਹੁੰਚਾ ਸਕੇ

ਛਿੜਕਾ ਕਰਨਾ ਚਾਹੀਦਾ ਹੈ ਅੱਜ ਕੱਲ

ਮੁਸ਼ਕਲ ਕਮੇਟੀ ਵੱਲੋਂ ਫੋਗ ਦੀ ਬਹੁਤ ਦਾ ਛਿੜਕਾ ਕੀਤਾ ਜਾਂਦਾ ਹੈ ਡੇਂਗੂ ਬੁਖਾਰ ਡੇਂਗੂ ਦਾ ਮਕਸਦ ਹਮੇਸ਼ਾ ਸਵੇਰੇ ਕੱਟਦਾ ਹੈ ਰਾਤ ਨੂੰ ਨਹੀਂ ਹਮੇਸ਼ਾ ਸਾਰੇ ਸਰੀਰ ਦੇ ਕੱਪੜੇ ਪਾ ਕੇ ਰੱਖੇ